ਹਾਂਜੀ ਸਤਿ ਸ਼੍ਰੀ ਅਕਾਲ ਏਜੰਟ ਤੋਂ ਬੋਲ ਰਹੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਦੱਸੋ ਕਿਸ ਟਾਈਪ ਦਾ ਚਾਹੀਦਾ ਤੁਹਾਨੂੰ ਹਾਂਜੀ ਹਾਂਜੀ ਸਾਡ ਸਾਡੇ ਕੋਲ ਫਰਨੀਸ਼ ਸੈਮੀ ਫਰਨੀਸ਼ ਅਤੇ ਅਨਫਰਨੀਸ਼ ਸਾਰੇ ਟਾਈਪ ਦੇ ਹੈਗੇ ਆ ਹਾਂਜੀ ਦੱਸੋ ਦੱਸੋ ਤੁਸੀਂ ਕਿਸ ਟਾਈਪ ਦੀ ਚਾਹੀਦੀ ਆ ਤੁਹਾਨੂੰ ਉਸ ਟਾਈਪ ਦੇ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਤੁਹਾਨੂੰ ਠੀਕ ਹੈ ਅਤੇ ਤੁਹਾਨੂੰ ਕਦੋਂ ਤੱਕ ਚਾਹੀਦਾ ਇਹ ਸਾਰਾ ਕੁਛ ਬੋਲੋ ਲੋਕੇਸ਼ਨ ਸੈਂਡ ਕਰ ਦਿਓ ਫਿਰ ਆਪਦੀ ਇਨਫੋਰਮੇਸ਼ਨ ਦੇ ਦਿਉ ਅਸੀਂ ਉਦੋਂ ਤੱਕ ਕੰਮ ਸ਼ੁਰੂ ਕਰਵਾ ਦੇਵਾਂਗੇ ਹਾਂ ਤੁਹਾਨੂੰ ਚਾਰਜਰ ਅਸੀਂ ਉਸ ਇਨਫੋਰਮੇਸ਼ਨ ਦੇ ਦੇਵਾਂਗੇ ਕੋਈ ਨਹੀਂ ਤੁਸੀਂ ਦੱਸੋ ਤੁਹਾਨੂੰ ਕਦੋਂ ਤੱਕ ਚਾਹੀਦਾ ਸਾਰਾ ਕੁਛ ਹਾਂਜੀ ਸਰ ਲੋਕੇਸ਼ਨ ਤੁਸੀਂ ਭੇਜ ਦਿਓ ਸਾਨੂੰ ਫੇਰ ਅਸੀਂ ਕੰਮ ਸ਼ੁਰੂ ਕਰਵਾ ਦੇਵਾਂਗੇ ਹੋਰ ਸਾ ਸਾ ਡਿਜ਼ਾਇਨ ਦਾ ਤੁਸੀਂ ਦੱਸ ਦਿਉ ਸਾਨੂੰ ਅਸੀਂ ਤੁਹਾਨੂੰ ਅੱਗੇ ਭੇਜ ਦੇਵਾਂਗੇ ਤੁਹਾਨੂੰ ਕਿਸ ਟਾਈਪ ਦੀ ਚਾਹੀਦੀ ਆ ਅਤੇ ਅਸੀਂ ਦੇ ਦੇਵਾਂਗੇ ਠੀਕ ਠੀਕ ਹੋਰ ਦੱਸੋ ਕਿ ਤੁਹਾਨੂੰ ਤੁਹਾਨੂੰ ਉਹ ਟੋਪ ਵਿੱਚ ਚਾਹੀਦੇ ਆ ਕਿ ਬੋਟਮ 'ਚ ਠੀਕ ਹੈ ਅਤੇ ਲੋਕੇਸ਼ਨ ਭੇਜ ਦਿਓ ਫੇਰ ਓਕੇ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਦੱਸੋ ਹਾਂਜੀ ਠੀਕ ਆ ਅਸੀਂ ਤੁਹਾਨੂੰ ਹੁਣੇ ਵਟਸਐਪ 'ਤੇ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਤੁਸੀਂ ਕਨਫਰਮ ਕਰਕੇ ਦੱਸ ਦਿਓ ਅਤੇ ਤੁਹਾਨੂੰ ਅਸੀਂ ਸਾਰੀ ਡਿਟੇਲ ਭੇਜ ਦੇਵਾਂਗੇ ਓਕੇ